ਹਾਂਜੀ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਬਹੁਤ ਵਾਰੀ ਬਾਈਕ ਯਾਤਰਾ 'ਤੇ ਗਿਆ ਹਾਂ ਜਿਹਦੇ ਵਿੱਚ ਸਾਨੂੰ ਹਿਮਾਚਲ ਪ੍ਰਦੇਸ਼ ਆਦਿ ਘੁੰਮਣ ਥਾਵਾਂ 'ਤੇ ਬਹੁਤ ਜ਼ਿਆਦਾ ਗਏ ਹਨ ਬਾਈਕ 'ਤੇ ਯਾਤਰਾ ਬਹੁਤ ਤਰ੍ਹਾਂ ਦੀ ਕੀਤੀ ਹੈ ਜਾਂ ਆਪਣੇ ਦੋਸਤਾਂ ਨਾਲ ਅਤੇ ਆਪਣੀ ਫੈਮਿਲੀ ਨਾਲ ਵੀ ਰਿਸ਼ਤੇਦਾਰੀਆਂ 'ਚ ਗਿਆ ਹਾਂ ਅਤੇ ਬਾਈਕ ਦੀ ਯਾਤਰਾ ਜਿੱਦਾਂ ਕਿ ਅਸੀਂ ਘੁੰਮਣ ਫਿਰਨ ਤੌਰ 'ਤੇ ਗਏ ਹਾਂ ਅਤੇ ਉਹਦਾ ਬਾਈਕ ਦਾ ਬਹੁਤ ਫਾਇਦਾ ਹੈ ਅਸੀਂ ਜਿੱਥੇ ਮਰਜ਼ੀ ਰੋਕ ਕੇ ਆਪਣਾ ਖਾਣਾ ਪੀਣਾ ਖਾ ਸਕਦੇ ਹਾਂ ਅਤੇ ਹਾਂਜੀ ਬਹੁਤ ਜਗ੍ਹਾ ਮੈਂ ਬਾਈਕ ਦੀ ਯਾਤਰਾ ਕੀਤੀ ਹੈ